ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਤੁਸੀਂ ਦ ਕਲੋਥਿੰਗ ਦੀ ਦੁਕਾਨ ਤੋਂ ਬੋਲਦੇ ਪਏ ਹੋ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਮੇਰੀ ਨਾ ਬੋਡੀ ਸਟਰਕਚਰ ਥੋੜ੍ਹਾ ਅਲੱਗ ਜਿਹਾ ਹੈਗਾ ਹੈ ਇਸ ਕਰਕੇ ਮੈਂ ਕੱਪੜੇ ਥੋੜ੍ਹੇ ਇਹ ਦੂਸਰੇ ਅਡਵਾਂਸ ਟਾਈਪ ਪਾਉਂਦੇ ਹੈਗੇ ਹੈ ਤੁਸੀਂ ਬਣਵਾ ਸਕਦੇ ਹੋ ਇੱਦਾਂ ਦੇ ਚਲੋ ਮੈਂ ਤੁਹਾਨੂੰ ਆਪਣਾ ਸਾਈਜ਼ ਸਮਝਾ ਦਿੰਦਾ ਮੇਰਾ ਸਾਈਜ਼ ਮੇਰਾ ਹਾਈਟ ਹੈਗੀ ਆ ਫਾਈਵ ਏਟ ਅਤੇ ਮੇਰਾ ਵੇਟ ਹੈਗਾ ਫਿਫਟੀ ਫਾਈਵ ਕਿੱਲੋਸ ਅਤੇ ਮੇਰਾ ਬੋਡੀ ਸਟਰਕਚਰ ਥੋੜ੍ਹਾ ਬੀ ਐੱਮ ਆਈ ਏ ਲੈਵਲ 'ਤੇ ਜਾਈਏ ਤਾਂ ਏਟੀਨ ਪੁਆਇੰਟ ਫਾਈਵ ਹੈਗਾ ਆ ਉਸ ਹਿਸਾਬ ਨਾਲ ਤੁਸੀਂ ਕਿਹੜੇ ਕਿਹੜੇ ਕੱਪੜੇ ਜੋ ਤੁਸੀਂ ਮੈਨੂੰ ਦੇ ਸਕਦੇ ਹੋ ਸੋ ਉਹਦੀ ਵਰਾਇਟੀ ਦੱਸ ਦਿਓ ਮੈਨੂੰ ਅਤੇ ਅਲੱਗ ਅਲੱਗ ਤਰ੍ਹਾਂ ਦੇ ਕੰਪਨੀਜ਼ ਬਰੈਂਡ ਕਿਹੜਾ ਵਧੀਆ ਹੁੰਦਾ ਕਿਹੜਾ ਨਹੀਂ ਜ਼ਿਆਦਾ ਦੇ ਜ਼ਿਆਦਾ ਦੇਰ ਤੱਕ ਜਿਹੜਾ ਚੱਲਦਾ ਉਹ ਦੱਸ ਦਿਓ ਵੀਰ ਜੀ ਮੈਂ ਜ਼ਿਆਦਾਤਰ ਨੋਰਮਲੀ ਬਰੈਂਡਿੰਗ ਹੀ ਪਾਉਂਦਾ ਹੈਗਾ ਕਿਉਂਕਿ ਮੇਰੇ ਕਮ ਘਰਦੇ ਆਹੀ ਪ੍ਰੈਫਰ ਕਰਦੇ ਹੈਗੇ ਆ ਬਰੈਂਡਿੰਗ ਵਾਲਾ ਸਹੀ ਰੈ ਕੁਆਲਟੀ ਵਧੀਆ ਹੁੰਦੀ ਉਹਦੀ ਅ ਬਰੈਂਡਿੰਗ ਜਿਹੜੇ ਕੱਪੜੇ ਹੁੰਦੇ ਹੈ ਉਨ੍ਹਾਂ ਦੀ ਕੁਆਲਟੀ ਵਧੀਆ ਹੁੰਦੀ ਇਸ ਕਰਕੇ ਤੁਸੀਂ ਬਰੈਂਡਿੰਗ ਪ੍ਰੈਫਰ ਕਰੂੰਗਾ ਮੈਂ ਮੇਰਾ ਹਾਇਟ ਹੈਗੀ ਆ ਪੰਜ ਫੁੱਟ ਅੱਠ ਇੰਚ ਭਾਰ ਹੈਗਾ ਮੇਰਾ ਪਚਵੰਜਾ ਕਿੱਲੋ ਅਤੇ ਮੇਰੀ ਬੀ ਐੱਮ ਆਈ ਹੈਗੀ ਆ ਅਠਾਰਾਂ ਪੁਆਇੰਟ ਪੰਜ

ਸਰ ਤੁਸੀਂ ਕੋਈ ਹੋਰ ਕਰ ਸਕਦੇ ਹੋ ਕਲਰ ਮਤਲਬ ਬਲੈਕ ਕਲਰ ਦੇ ਵਿੱਚ ਜਾਂ ਕਾਲਾ ਰੰਗ ਜਾਂ ਬ੍ਰਾਊਨ ਜਾਂ ਭੂਰਾ ਜਿਹਾ ਟਾਈਪ ਤੁਹਾਡੇ ਕੋਲ ਹੋਰ ਕਿਹੜੀ ਕਿਹੜੀ ਵਰਾਇਟੀ ਦਾ ਦੱਸੋ ਵੀਰ ਜੀ ਤੁਸੀਂ ਜ਼ੁਡੀਓ ਬਰੈਂਡ ਦਾ ਰੱਖਦੇ ਹੋ ਤੁਸੀਂ ਵੀਰ ਜੀ ਤੁਸੀਂ ਜ਼ੁਡੀਓ ਬਰੈਂਡ ਦਾ ਰੱਖਦੇ ਹੋ ਅ ਅਤੇ ਹੋਰ ਕਿਹੜਾ ਕਿਹੜਾ ਬਰੈਂਡ ਹੈਗਾ ਆ ਅਤੇ ਤੁਹਾਡੇ ਜਿਹੜੇ ਤੁਹਾਡਾ ਜਿਹੜਾ ਬਰੈਂਡ ਜਿਹੜੇ ਕੱਪੜੇ ਆ ਚ ਚਲੋ ਐਡੀਦਾਸ ਮੰਨ ਲੈਂਦੇ ਹਾਂ ਆਪਾਂ ਤਾਂ ਉਹ ਬਾਹਰੋਂ ਆਉਂਦੇ ਹੈ ਕਿ ਤੁਸੀਂ ਅਪ ਇੱਧਰੋਂ ਕਰਦੇ ਹੋ ਇੰਪੋਰਟ ਕਰਾਉਂਦੇ ਜਾਂ ਐਕਸਪੋਰਟ ਕਰਦੇ ਹੋ ਠੀਕ ਹੈ ਅਤੇ ਤੁਹਾਡੀ ਦੁਕਾਨ ਵੈਸੇ ਦੁਕਾਨ ਹੈਗੀ ਕਿ ਤੁਹਾਡਾ ਉਹ ਹੈਗਾ ਆ ਸ਼ੋਰੂਮ ਟਾਈਪ ਹੈਗਾ ਅਤੇ ਸ਼ੋਰੂਮ ਦੀ ਤੁਸੀਂ ਮੈਨੂੰ ਐਗਜੈਕਟ ਲੋਕੇਸ਼ਨ ਦੱਸ ਦੂੰਗੇ ਅਤੇ ਓਧਰਲੀ ਸਾਈਡ ਤਾਂ ਭਾਈ ਵੀਰ ਜੀ ਮੇਰਾ ਥੋੜ੍ਹਾ ਆਉਣਾ ਔਖਾ ਹੋ ਜਾ ਜੀ ਐੱਨ ਈ ਕੋਲੇਜ ਦਾ ਨਾਮ ਬਹੁਤ ਸੁਣਿਆ ਹੋਇਆ ਇਸ ਕਰਕੇ ਉਹਦੀ ਮੈਨੂੰ ਪ੍ਰਫੈਕਟ ਲੋਕੇਸ਼ਨ ਦੱਸ ਦਿਓ ਕਿੱਥੇ ਹੈਗੀ ਹੈ ਤੋ ਤੁਸੀਂ ਆਪਣਾ ਮੈਨੂੰ ਇੱਕ ਵਾਰ ਕਾਂਟੈਕਟ ਹੀ ਦੱਸ ਦਿਓ ਅਤੇ ਆਪਣਾ ਨਾਮ ਵਗੈਰਾ ਦੱਸ ਦਿਓ ਅਤੇ ਤੁਹਾਡੇ ਜਿਹੜੇ ਦੂਸਰੇ ਜਿਹੜੇ ਤੁਹਾਡਾ ਜਿਹੜਾ ਆਊਗਾ ਉਹਦਾ ਨਾਮ ਦੱਸ ਦਿਓ ਮੈਨੂੰ ਠੀਕ ਹੈ ਵੀਰ ਜੀ ਮੈਂ ਤੁਹਾਨੂੰ ਥੋੜ੍ਹੀ ਦੇਰ ਨੂੰ ਕੌਲ ਕਰਦਾ ਹਾਂ